ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਸਾਡਾ ਪਿਛੋਕੜ ਪੰਜਾਬੀ ਹੈ ਸਾਡੇ ਦਾਦੇ ਪੜਦਾਦੇ ਸਾਰੇ ਪੰਜਾਬ ਚੋ ਹਨ ਅਸੀਂ ਉਹਨਾਂ ਦੀ ਸਿੱਖ ਤੋਂ ਹੀ ਪੰਜਾਬੀ ਸਿੱਖੀ ਹੈ ਅਤੇ ਸਾਨੂੰ ਪੰਜਾਬ ਵਿੱਚ ਰਹਿਣ ਦਾ ਮੌਕਾ ਮਿਲਿਆ ਹੈ ਇਸ ਭਾਸ਼ਾ ਨਾਲ ਸਾਡਾ ਬਹੁਤ ਹੀ ਵਧੀਆ ਅਨੁਭਵ ਹੈ ਪੰਜਾਬੀ ਪੰਜਾਬੀ ਜੋ ਕਿ ਪੰਜਾਬ ਦੀ ਮਾਂ ਬੋਲੀ ਹੈ ਅਤੇ ਪੰਜਾਬ ਲਈ ਇੱਕ ਉੱਚ ਭਾਸ਼ਾ ਹੈ ਪੰਜਾਬੀ ਪੰਜਾਬੀ ਹਰ ਇੱਕ ਦੇ ਦਿਲ ਵਿੱਚ ਵਸਣ ਵਾਲੀ ਭਾਸ਼ਾ ਹੈ ਪੰਜਾਬੀ ਸਾਨੂੰ ਬਚਪਨ ਤੋਂ ਹੀ ਆਪਣੇ ਦਾਦੇ ਪਰਦਾਦਿਆਂ ਦੇ ਪਿਛੋਕੜ ਤੋਂ ਅਤੇ ਰਹਿਣ ਸਹਿਣ ਤੋਂ ਸਾਨੂੰ ਪੰਜਾਬੀ ਦਾ ਪਤਾ ਲੱਗਿਆ ਹੈ ਪੰਜਾਬੀ ਭਾਸ਼ਾ ਦਾ ਅਨੁਭਵ ਸਾਡੇ ਲਈ ਇੱਕ ਬਹੁਤ ਹੀ ਵਧੀਆ ਰਿਹਾ ਹੈ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਇਸ ਲਈ ਸਾਡੀ ਮਾਂ ਬੋਲੀ ਪੰਜਾਬੀ ਹੈ ਅਤੇ ਸਾਨੂੰ ਪੰਜਾਬ ਦੀ ਇਸ ਮਾਂ ਬੋਲੀ ਨਾਲ ਬਹੁਤ ਹੀ ਪਿਆਰ ਹੈ ਅਤੇ ਅਸੀਂ ਇੱਥੇ ਰਹਿ ਕੇ ਪੰਜਾਬੀ ਸਿੱਖੇ ਹਨ ਬੋਲਣ ਲੱਗੇ ਹਨ ਅਤੇ ਪੰਜਾਬ ਵੀ ਰਹਿਣਾ ਸਹਿਣਾ ਅਤੇ ਪੰਜਾਬੀ ਤਿਉਹਾਰਾਂ ਦਾ ਪਤਾ ਲੱਗਿਆ ਪੰਜਾਬ ਵਿੱਚ ਰਹਿ ਕੇ ਅਸੀਂ ਪੰਜਾਬ ਦੇ ਰਹਿਣ ਸਹਿਣ ਪੰਜਾਬ ਦੇ ਤਿਉਹਾਰਾਂ ਅਤੇ ਪੰਜਾਬੀ ਬੋਲਾਂ ਬਾਰੇ ਸਿੱਖਿਆ ਹੈ ਇਸ ਨਾਲ ਸਾਡਾ ਸਾਨੂੰ ਪੰਜਾਬੀ ਦਾ ਪਤਾ ਲੱਗਿਆ ਅਤੇ ਪੰਜਾਬ ਵਿੱਚ ਹਰ ਇੱਕ ਚੀਜ਼ ਦਾ ਪਤਾ ਲੱਗਿਆ ਇਸ ਨਾਲ ਸਾਡਾ ਪੰਜਾਬੀ ਭਾਸ਼ਾ ਦਾ ਅਨੁਭਵ ਬਹੁਤ ਹੀ ਵਧੀਆ ਰਿ